ਹਾਂਜੀ ਮੇਰੇ ਮਨ ਪਸੰਦ ਗੇਮਾਂ ਬਹੁਤ ਹਨ ਯਾਨੀ ਕਿ ਸਭ ਤੋਂ ਮਨ ਪਸੰਦ ਗੇਮ ਕਬੱਡੀ ਹੈ ਕਬੱਡੀ ਮੈਂ ਖੇਡਦਾ ਵੀ ਹਾਂ ਅਤੇ ਦੇਖਣ ਵੀ ਜਾਂਦਾ ਹਾਂ ਜਿੱਦਾਂ ਕਿ ਪੰਜਾਬ ਦੇ ਵਿੱਚ ਟੂਰਨਾਮੈਂਟ ਹੋਣ ਜਿੱਦਾਂ ਬਾਹਰੋਂ ਟੀਮਾਂ ਬਹੁਤ ਆਉਂਦੀਆਂ ਹਨ ਖੇਡਣ ਲਈ ਉਹ ਵੀ ਆਪਣਾ ਸਾਰੇ ਮਨੋਰੰਜਨ ਕਰਦੇ ਹਨ ਅਤੇ ਲੋਕ ਬਹੁਤ ਦੇਖਣ ਆਉਂਦੇ ਹਨ ਸਾਰੇ ਮਨੋਰੰਜਨ ਕਰਦੇ ਹਨ ਸਭ ਇੱਕ ਤੋਂ ਇੱਕ ਖਿਡਾਰੀ ਹੁੰਦਾ ਹੈ ਅਤੇ ਮੈਂ ਵੀ ਬਹੁਤ ਪਸੰਦ ਕਰਦਾ ਦੇਖਣਾ ਅਤੇ ਖੇਡਣਾ ਕਬੱਡੀ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਬੱਡੀ ਦੇ ਵਿੱਚ ਸੱਤ ਖਿਡਾਰੀ ਹੁੰਦੇ ਹਨ ਤਾਂ ਇੱਕ ਰੇਡ ਪਾਉਣ ਜਾਂਦਾ ਹੈ ਤਾਂ ਉਹ ਆਪਣਾ ਪੁਆਇੰਟ ਲੈ ਕੇ ਵੀ ਆ ਜਾਂਦਾ ਹੈ ਜਾਂ ਬਾ ਬਾਈ ਚਾਂਸ ਦੂਜਾ ਬੰਦਾ ਵੀ ਪੁਆਇੰਟ ਲੈ ਲੈਂਦਾ ਹੈ ਕਬੱਡੀ ਬਹੁਤ ਵਧੀਆ ਗੇਮ ਹੈ ਇਹ ਪਰ ਧਿਆਨ ਨਾਲ ਖੇਡਣੀ ਪੈਂਦੀ ਹੈ ਇਹਦੇ ਵਿੱਚ ਅੰਗ ਪੈਰ ਵੀ ਹਿੱਲ ਸਕਦਾ ਹੈ ਬੰਦੇ ਦਾ ਕਬੱਡੀ ਤਾਂ ਹਰ ਪਿੰਡ ਦੇ ਵਿੱਚ ਕਰਵਾਉਂਦੇ ਹਨ ਅਤੇ ਸਾਨੂੰ ਖੇਡਾਂ ਖੇਡਣੀ ਚਾਹੀਦੀਆਂ ਹਨ ਜਦਕਿ ਸਾਡਾ ਮਨ ਸੰਤੁਸ਼ਟੀ ਆਦਿ ਸਹੀ ਰਹਿੰਦਾ ਹੈ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੁੰਦਾ ਹਨ ਖੇਡਣ ਨਾਲ ਕੋਈ ਵੀ ਗੇਮ ਸਾਨੂੰ ਖੇਡਣੀ ਬਹੁਤ ਜ਼ਰੂਰੀ ਹੈ ਹਾਂਜੀ ਕ੍ਰਿਕਟ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਕ੍ਰਿਕਟ ਦੇ ਵਿੱਚ ਟੋਟਲ ਗਿਆਰ੍ਹਾਂ ਖਿਡਾਰੀ ਹੁੰਦੇ ਹਨ ਅਤੇ ਹਰੇਕ ਦੇ ਪਿੰਡ ਵਿੱਚ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਜਿੱਦਾਂ ਕਿ ਕ੍ਰਿਕਟ ਦਾ ਅਤੇ ਵੱਡੇ ਵੱਡੇ ਇਨਾਮ ਰੱਖੇ ਜਾਂਦੇ ਹਨ ਟੂਰਨਾਮੈਂਟ ਦੇ ਵਿੱਚ ਅਤੇ ਹੋਰ ਆਦਿ ਸਮਾਨ ਵੀ ਦਿੱਤਾ ਜਾਂਦਾ ਹੈ ਜਿਹੜਾ ਖਿਡਾਰੀ ਵਧੀਆ ਖੇਡੇ ਤਾਂ ਉਹਨੂੰ ਵਧੀਆ ਸਨਮਾਨਿਤ ਚਿੰਨ੍ਹ ਦਿੱਤਾ ਜਾਂਦਾ ਹੈ ਜਿਹੜੀ ਟੀਮ ਜਿੱਤਦੀ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਂਦਾ ਹੈ ਜਿੱਦਾਂ ਕਿ ਲੱਖ ਦੋ ਲੱਖ ਅਤੇ ਆਦਿ ਜਿਹੜਾ ਬੈਸਟ ਚੁਣਿਆ ਜਾਂਦਾ ਹੈ ਤਾਂ ਉਹਨੂੰ ਵੀ ਕੁਛ ਅਲੱਗ ਅਲੱਗ ਇਨਾਮ ਦਿੱਤੇ ਜਾਂਦੇ ਹਨ